ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਭਾਅ ਜੀ ਠੀਕ ਠਾਕ ਜੀ ਹੋਰ ਘਰ ਪਰਿਵਾਰ ਬੱਚੇ ਠੀਕ ਠਾਕ ਸਭ ਭਾਅ ਜੀ ਗੱਲ ਇਸ ਤਰ੍ਹਾਂ ਸੀ ਕਿ ਅਸੀਂ ਬੱਚਿਆਂ ਨੂੰ ਹੁਣ ਹੋਈਆਂ ਛੁੱਟੀਆਂ ਸਕੂਲੋਂ ਨਾ ਅਸੀਂ ਪਰਿਵਾਰ ਸਮੇਤ ਥੋੜ੍ਹਾ ਜਾਣਾ ਸੀ ਬਾਹਰ ਕਿਤੇ ਘੁੰਮਣ ਬੱਚਿਆਂ ਸਮੇਤ ਬੱਚੇ ਕਹਿ ਦਿੰਦੇ ਕਿ ਛੁੱਟੀਆਂ 'ਤੇ ਥੋੜ੍ਹਾ ਕਿਤੇ ਘੁੰਮ ਫਿਰ ਆਈਏ ਅਤੇ ਅਸੀਂ ਜਾਣਾ ਕੋਈ ਚਾਰ ਪੰਜ ਦਿਨ ਦਾ ਟੂਰ ਆ ਸਾਡਾ ਅਸੀਂ ਅੰਬਰਸਰ ਤੋਂ ਜਾਣਾ ਅਸੀਂ ਸ਼੍ਰੀਨਗਰ ਜਾਣਾ ਘੁੰਮਣ ਸ਼੍ਰੀਨਗਰ ਤੋਂ ਬਾਅਦ ਹੋ ਸਕਦਾ ਅਸੀਂ ਹਿਮਾਚਲ ਵੱਲ ਵੀ ਦੋ ਦੋ ਕੁ ਦਿਨ ਘੁੰਮ ਕੇ ਆਈਏ ਅਤੇ ਭਾਅ ਜੀ ਗੱਲ ਇਸ ਤਰ੍ਹਾਂ ਕਿ ਸਾਨੂੰ ਗੱਡੀ ਚਾਹੀਦੀ ਹੀ ਛੋਟੀ ਗੱਡੀ ਹੋਏ ਚਾਰ ਚਾਰ ਸੀਟਰ ਹੋਏ ਅਤੇ ਡਰਾਈਵਰ ਦੀ ਜ਼ਰੂਰਤ ਨਹੀਂ ਡਰਾਈਵਰ ਅਸੀਂ ਆਪ ਹੀ ਡਰਾਈਵਿੰਗ ਕਰ ਲੈਣੀ ਹੈ ਬਸ ਸਾਨੂੰ ਗੱਡੀ ਗੱਡੀ ਚਾਹੀਦੀ ਹੈ ਅਤੇ ਗੱਡੀ ਦੇ ਕਾਗਜ਼ ਵਗੈਰਾ ਸਾਰੇ ਓਕੇ ਹੋਣ ਕਿਉਂਕਿ ਰਾਹ 'ਚ ਕੋਈ ਦਿੱਕਤ ਨਾ ਆਏ ਸਾਨੂੰ ਤੁਹਾਨੂੰ ਪਤਾ ਰਾਹ 'ਚ ਅੱਜ ਕੱਲ੍ਹ ਬਹੁਤ ਚੈਕਿੰਗ ਚੁਕਿੰਗ ਬਹੁਤ ਕਰਦੇ ਆ ਇਸ ਕਰਕੇ ਅਸੀਂ ਪਰਿਵਾਰ ਦੇ ਨਾਲ ਜਾਣਾ ਅਤੇ ਕੋਈ ਰਾਹ 'ਚ ਦਿੱਕਤ ਨਾ ਆਏ ਬਾਕੀ ਗੱਡੀ ਵੀ ਸਾਨੂੰ ਵਧੀਆ ਦਿਓ ਕਿ ਰਾਹ 'ਚ ਕੋਈ ਖਰਾਬੀ ਨਾ ਕਰੇ ਠੀਕ ਠਾਕ ਅਸੀਂ ਹੋ ਕੇ ਆਪਣੇ ਬੱਚਿਆਂ ਦੇ ਨਾਲ ਇੰਜੁਆਏ ਕਰਕੇ ਅਤੇ ਆ ਜਾਈਏ ਠੀਕ